ਵੈਸੇ ਤਾਂ ਜ਼ਿੰਦਗੀ ਰੋਜ਼ ਹੀ ਕੋਈ ਨਾ ਕੋਈ ਨਵਾਂ ਸਬਕ ਸਿਖਾਉਂਦੀ ਹੈ ਪਰ ਸਭ ਤੋਂ ਮਹੱਤਵਪੂਰਨ ਸਬਕ ਹੈ ਜ਼ਿੰਦਗੀ ਨੇ ਇਹ ਸਿਖਾਇਆ ਹੈ ਕਿ ਕਿਸੇ 'ਤੇ ਵੀ ਅੱਖਾਂ ਮੁੰਦ ਕੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਉਂਕਿ ਹਰ ਕੋਈ ਤੁਹਾਡੀ ਕਮਜ਼ੋਰੀ ਦਾ ਫਾਇਦਾ ਉਠਾ ਕੇ ਤੁਹਾਨੂੰ ਛੱਲ ਜਾਂਦਾ ਹੈ ਜਿਸ ਤੋਂ ਬਚਣ ਲਈ ਸਾਨੂੰ ਆਪਣੇ ਆਪ ਨੂੰ ਸਮਝਾਉਣਾ ਪਵੇਗਾ ਕਿ ਅੱਖਾਂ ਮੁੰਦ ਕੇ ਕਿਸੇ 'ਤੇ ਵਿਸ਼ਵਾਸ ਨਾ ਕਰੀਏ